ਸਾਡੇ ਪਿੰਡ ਦੇ ਲੋਕ ਹਰੇਕ ਖਿੱਤੇ ਦੇ ਬਿਜ਼ਨਸ ਕਰਦੇ ਨੇ ਸਾਡੇ ਪਿੰਡ ਵਿੱਚ ਕਰਿਆਨੇ ਦੀ ਦੀਆਂ ਦੁਕਾਨਾਂ ਬਿਜਲੀ ਬਣਾਉਣ ਵਾਲੇ ਮਕੈਨਿਕ ਮੋਟਰਸਾਈਕਲ ਕਾਰਾਂ ਬਣਾਉਣ ਵਾਲੇ ਮਕੈਨਿਕ ਟਰੈਕਟਰ ਟਰਾਲੀਆਂ ਰਿਪੇਅਰ ਕਰਨ ਵਾਲੇ ਮਕੈਨਿਕ ਹੋਰ ਵੀ ਕਈ ਤਰ੍ਹਾਂ ਦੇ ਬਿਜ਼ਨਸ ਸਾਡੇ ਪਿੰਡ ਵਿੱਚ ਕੀਤੇ ਜਾਂਦੇ ਨੇ ਖ਼ਾਸ ਤੌਰ 'ਤੇ ਸਾਡੇ ਪਿੰਡ ਦੇ ਲੋਕ ਮਿੱਟੀ ਦੇ ਬਰਤਨ ਬਣਾਉਣ ਦਾ ਵੀ ਬਹੁਤ ਜ਼ਿਆਦਾ ਕੰਮ ਕਰਦੇ ਨੇ ਕਿਉਂਕਿ ਸਾਡੇ ਪਿੰਡ ਦੀ ਮਿੱਟੀ ਬਹੁਤ ਹੀ ਵਧੀਆ ਹੋਣ ਕਰਕੇ ਇੱਥੋਂ ਦੇ ਬਰਤਨ ਬੜੀ ਦੂਰ ਦੂਰ ਤੱਕ ਵੇਚੇ ਜਾਂਦੇ ਨੇ ਸਾਡੇ ਪਿੰਡ ਵਿੱਚ ਮੋਟਰਾਂ ਰਿਪੇਅਰ ਕਰਨ ਵਾਲੇ ਵੀ ਮਿਸਤਰੀ ਹਨ ਹੋਰ ਆਧੁਨਿਕ ਸੰਦਾਂ ਨੂੰ ਰਿਪੇਅਰ ਕਰਨ ਵਾਲੇ ਮਿਸਤਰੀ ਵੀ ਸਾਡੇ ਪਿੰਡ ਵਿੱਚ ਮੌਜੂਦ ਹਨ ਇਸ ਲਈ ਸਾਡੇ ਪਿੰਡ ਵਿੱਚ ਹਰੇਕ ਤਰੀਕੇ ਦੇ ਬਿਜਨਸ ਕੀਤਾ ਜਾਂਦਾ ਹੈ